ਹੈਲੋ ਨਮਸਕਾਰ ਸਰ ਬਸ ਵਧੀਆ ਵਧੀਆ ਸਰ ਹਾਂਜੀ ਸਰ ਮੈਂ ਭਾਰਤ ਭੂਸ਼ਨ ਬੋਲਿਆ ਕਰਦਾ ਜੀ ਅਤੇ ਮੈਂ ਨਾ ਪਠਾਨਕੋਟ ਆਇਆ ਤਾ ਜੀ ਫੈਮਲੀ ਨਾਲ ਘੁੰਮਣ ਹਾਂਜੀ ਅਤੇ ਮੈਨੂੰ ਹੋ ਗਿਆ ਕਾਫੀ ਟਾਈਮ ਹੋ ਗਿਆ ਇੱਧਰ ਘੁੰਮਦੇ ਅਤੇ ਥਕਾਵਟ ਜਿਹੀ ਹੋ ਗਈ ਸੀ ਮੈਂ ਸੋਚਿਆ ਸੀ ਲਾਗੇ ਛਾਗੇ ਕੋਈ ਗੁਰਦੁਆਰਾ ਹੈਗਾ ਥੋੜ੍ਹੀ ਜਾਣਕਾਰੀ ਦਿਓਗੇ

ਠੀਕ ਹੈ ਜੀ

ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਠੀ ਅਤੇ ਸਰ ਇਹ ਪਠਾ ਪਠਾਨਕੋਟ ਤੋਂ ਕਿੰਨੀ ਕੁ ਦੂਰੀ 'ਤੇ ਆ ਕਿੱਦਾਂ ਕਿੱਦਾਂ ਜਾਣਾ ਹੋਏਗਾ ਇਹਦੇ 'ਤੇ ਮੈਂ ਫਿਲਹਾਲ ਇਸ ਸਮੇਂ ਗਾਂਧੀ ਚੌਂਕ ਦੇ ਲਾਗੇ ਹਾਂ ਜੀ ਹਾਂਜੀ ਹਾਂ ਹਾਂ ਸਟੇਅ ਕਰਨ ਨੂੰ ਜਗ੍ਹਾ ਹੈਗੀ ਆ ਨਾ ਉੱਥੇ ਠੀਕ ਹੈ ਜੀ

ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਥੈਂਕਯੂ ਯੂ